ਮੈਂ ਸੋਚਦੀ ਹਾਂ ਕਿ ਸਕੂਲੀ ਪੜ੍ਹਾਈ ਤੋਂ ਬਾਅਦ ਜਿਹੜੇ ਵਿਦਿਆਰਥੀ ਹਨ ਉਹ ਵਧੀਆ ਸਿੱਖਸ ਸਿੱਖਿਆ ਪ੍ਰਾਪਤ ਕਰਦੇ ਹਨ ਦੇਖੋ ਕਈ ਤਾਂ ਜਿਹੜੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਪਰਿਵਾਰ ਦੇ ਜਿਹੜੇ ਉਹਨਾਂ ਦੇ ਕਾਰੋਬਾਰ ਚਲਦਾ ਉਹਦੇ ਵਿੱਚ ਹੀ ਚਲੇ ਜਾਂਦੇ ਹਨ ਅਤੇ ਕਈ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਕਿ ਜਿਹੜੀ ਉੱਚ ਸਿੱਖਿਆ ਪ੍ਰਾਪਤ ਕਰ ਲੈਂਦੇ ਹਨ ਉੱਚੀ ਨੌਕਰੀ ਵੀ ਉਹਨਾਂ ਨੂੰ ਮਿਲ ਜਾਂਦੀ ਹੈ ਜਿਵੇਂ ਡਾਕਟਰ ਹੈ ਕੋਈ ਇੰਜੀਨੀਅਰ ਹੈ ਕੋਈ ਡਾਕਟਰ ਇੰਜੀਨੀਅਰ ਹੋ ਗਿਆ ਆਪਣਾ ਕੋਈ ਰੇਲਵੇ 'ਚ ਚਲਾ ਗਿਆ ਜਾਂ ਫਿਰ ਕੋਈ ਕਾਫੀ ਅੱਛਾ ਆਪਣਾ ਕਾਰੋਬਾਰ ਵੀ ਕੋਈ ਖੋਲ੍ਹ ਲੈਂਦੇ ਹਨ ਪਰ ਇਹਦੇ ਵਿੱਚ ਇਹ ਹੈ ਕਿ ਸਰਕਾਰ ਵੀ ਬੱਚਿਆਂ ਦੀ ਪੜ੍ਹਾਈ ਦਾ ਵੱਧ ਤੋਂ ਵੱਧ ਜਿਹੜੇ ਹੈਗੇ ਨੇ ਆਪਣੇ ਅਵਸਰ ਪ੍ਰਦਾਨ ਕਰੇ ਤਾਂ ਕਿ ਬੱਚੇ ਪੜ੍ਹ ਲਿਖ ਕੇ ਥੋੜ੍ਹਾ ਹੋਰ ਉੱਚੀ ਸਿੱਖਿਆ ਪ੍ਰਾਪਤ ਕਰਨ ਇਹ ਦੇਖੋ ਨਾ ਜਿਹੜੇ ਕਿ ਕਈ ਗਰੀਬ ਪਰਿਵਾਰ ਦੇ ਲੋਕ ਵੀ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਕਈ ਪੜ੍ਹਾ ਵੀ ਨਹੀਂ ਸਕਦੇ ਪਰ ਬੱਚੇ ਦੀ ਪੜ੍ਹਨ ਦੀ ਇੱਛਾ ਵੀ ਹੁੰਦੀ ਹੈ ਪਰ ਕਈ ਮਾਂ ਪਿਉ ਪੜ੍ਹਾ ਨਹੀਂ ਸਕਦੇ ਅਫੋਰਡ ਨਹੀਂ ਕਰ ਸਕਦੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਪਰ ਸਰਕਾਰ ਵੀ ਇਹਨਾਂ ਬੱਚਿਆਂ ਦਾ ਧਿਆਨ ਦੇਵੇ ਅਤੇ ਬੱਚੇ ਪੜ੍ਹਨਗੇ ਤਾਂ ਤਾਂ ਹੀ ਦੇਸ਼ ਦਾ ਭਵਿੱਖ ਵੀ ਉਜਵਲ ਹੋਏਗਾ ਬੱਚਿਆਂ ਦਾ ਭਵਿੱਖ ਤਾਂ ਹੋਣਾ ਹੀ ਹੋਣਾ ਇਸ ਬੱਚਿਆਂ ਦਾ ਬੱਚਿਆਂ ਦੇ ਨਾਲ ਨਾਲ ਦੇਸ਼ ਦਾ ਭਵਿੱਖ ਵੀ ਉਜਵਲ ਹੋਏਗਾ ਬੱਚੇ ਪੜ੍ਹ ਕੇ ਅੱਜ ਕੱਲ੍ਹ ਕਈ ਜਿਹੜੇ ਉੱਚ ਡਿਗਰੀਆਂ ਪ੍ਰਾਪਤ ਕਰ ਰਹੇ ਹਨ ਕੋਈ ਐੱਨ ਸੀ ਸੀ 'ਚ ਜਾ ਰਿਹਾ ਕੋਈ ਟੈਕਨੀਕਲ ਕੋਈ ਇੰਜੀਨੀਅਰ ਕੋਈ ਕੁਛ ਬਣ ਰਿਹਾ ਕੋਈ ਡੋਕਟਰ ਬਣ ਰਿਹਾ ਸਰਕਾਰ ਇਹ ਵਧੀਆ ਤੋਂ ਵਧੀਆ ਟੈਕਨੋਲੋਜੀ ਅਪਣਾਵੇ ਬੱਚਿਆਂ ਦਾ ਭਵਿੱਖ ਉਜਵਲ ਕਰੇ ਅਤੇ ਉਹਨਾਂ ਦੇ ਮਾਂ ਪਿਉ ਦਾ ਭਵਿੱਖ ਵੀ ਉਜਵਲ ਹੋਵੇ ਦੇਸ਼ ਦਾ ਭਵਿੱਖ ਵੀ ਉਜਵਲ ਹੋਵੇ